ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ 'ਤੇ ਮਹਾਨ ਗੁਰੂ ਕਵੀ ਅਤੇ ਯੋਧੇ ਪੈਦਾ ਹੋਏ ਹਨ ਜਿਵੇਂ ਕਿ ਬਾਬਾ ਫਰੀਦ ਜੀ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਨੇ ਇੱਥੇ ਗੁਰੂ ਅੰ ਅੰਗਦ ਦੇਵ ਜੀ ਦੇ ਗੁਰੂ ਰਾਮਦਾਸ ਜੀ ਕਿ ਗੁਰੂ ਦਸ ਗੁਰੂ ਸਾਹਿਬਾਨ ਦਾ ਇੱਥੇ ਕਈਆਂ ਦੇ ਚਰਨ ਪਏ ਹਨ ਪੰਜਾਬ ਦੀ ਧਰਤੀ 'ਤੇ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਸੋ ਕੋਈ ਟਾਈਮ ਸੀ ਇਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਦਰਿਆ ਦੇ ਨਾਲ ਨਾਲ ਉਪਜਾਊ ਧਰਤੀ ਹੈ ਕਣਕ ਅਤੇ ਝੋਨੇ ਦੀ ਫਸਲ ਪੰਜਾਬ ਤੋਂ ਸਭ ਤੋਂ ਵੱਧ ਉਪਜ ਹੁੰਦੀ ਹੈ ਇੱਥੋਂ ਅਨਾਜ ਬਾਹਰ ਭੇਜਿਆ ਜਾਂਦਾ ਹੈ ਕਈਆਂ ਦੀਆਂ ਕਈਆਂ ਦੀਆਂ ਭੁੱਖ ਪੂਰੀ ਕਰਨ ਵਾਸਤੇ ਇਹ ਅਨਾਜ ਬਾਹਰ ਭੇਜਿਆ ਜਾਂਦਾ ਹੈ ਕਈਆਂ ਨੂੰ ਢਿੱਡ ਭਰ ਕੇ ਰੋਟੀ ਮਿਲਦੀ ਹੈ ਇਸ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਇਥੋਂ ਦੇ ਸੋਹਣੇ ਛੈਲ ਛਬੀਲੇ ਗੱਭਰੂ ਹਨ ਇੱਥੇ ਭੰਗੜੇ ਅਤੇ ਗਿੱਧੇ ਦੀਆਂ ਬਹੁਤ ਰੌਣਕਾਂ ਲੱਗਦੀਆਂ ਹਨ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਹੈ ਕੋਈ ਇਤਿਹਾਸਿਕ ਕੋਈ ਗੁਰਦੁਆਰਿਆਂ ਵਿੱਚ ਵੀ ਬਹੁਤ ਰੌਣਕਾਂ ਹੁੰਦੀਆਂ ਹਨ ਉੱਨੀ ਸੌ ਸੰਤਾਲੀ ਵਿੱਚ ਪਾਕਿਸਤਾਨ ਨਾਲੋਂ ਵੰਡ ਹੋਈ ਉੱਨੀ ਸੌ ਛਿਆਹਠ ਵੇਲੇ ਹਰਿਆਣਾ ਅਤੇ ਹਿਮਾਚਲ ਅੱਡ ਹੋਏ ਰਾਜਧਾਨੀ ਸ਼ਿਮਲੇ ਤੋਂ ਚੰਡੀਗੜ੍ਹ ਕੀਤੀ ਗਈ ਉੱਨੀ ਸੌ ਇਕਹੱਤਰ ਵੇਲੇ ਪਾਕਿਸਤਾਨ ਨਾਲ ਕਾਰਗਿਲ ਦਾ ਯੁੱਧ ਹੋਇਆ ਅਤੇ ਬੰਗਲਾਦੇਸ਼ ਬਣਿਆ ਜਿਸ ਦਾ ਬਹੁਤ ਮਾੜਾ ਪ੍ਰਭਾਵ ਪਿਆ ਪਾਕਿਸਤਾਨ ਨਾਲ ਪੰਜਾਬ ਦੇ ਬਾਰਡਰ ਲੱਗਣ ਕਾਰਨ ਪੰਜਾਬ ਦਾ ਖਤਰਾ ਬਣਿਆ ਰਹਿੰਦਾ ਉੱਨੀ ਸੌ ਚੁਰਾਸੀ ਵੇਲੇ ਸਾਕਾ ਨੀਲਾ ਤਾਰਾ ਵਰਤਿਆ ਜਿਸ ਕਰਕੇ ਪੰਜ ਗੁਰਦੁਆਰਿਆਂ 'ਤੇ ਬਹੁਤ ਨੁਕਸਾਨ ਹੋਇਆ ਸ਼੍ਰੀ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ ਗਿਆ ਅਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਅਤੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਦਿੱਲੀ ਦੇ ਵਿੱਚ ਬਹੁਤ ਦੰਗੇ ਫਸਾਦ ਹੋਏ ਅਤੇ ਇਸ ਕਰਕੇ ਗੁਰਦੁਆਰਿਆਂ ਅੰਮ੍ਰਿਤਸਰ ਸਾਹਿਬ ਦਾ ਵੀ ਬਹੁਤ ਨੁਕਸਾਨ ਹੋਇਆ